ਕੁਝ ਸਥਾਨਕ ਸਿੱਖਿਆ ਜਾਂ ਸਿੱਖਣ ਦੇ ਮੌਕੇ ਲਈ ਰੂਪਨਗਰ ਜ਼ਿਲ੍ਹੇ ਵਿੱਚ ਅਲੱਗ ਅਲੱਗ ਕੰਪਿਊਟਰ ਸੈਂਟਰਸ ਖੁੱਲ੍ਹੇ ਹੋਏ ਹਨ ਅਲੱਗ ਅਲੱਗ ਲਾਈਟ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਹਨ ਉਸ ਤੋਂ ਇਲਾਵਾ ਸਰਕਾਰੀ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਅਲੱਗ ਅਲੱਗ ਬਹੁਤ ਸਾਰੇ ਗਰਾਊਂਡ ਜੋ ਹੈ ਉਹ ਹਨ ਅਤੇ ਉਸ ਤੋਂ ਇਲਾਵਾ ਸਮਾਰਟ ਕਲਾਸ ਰੂਮਜ਼ ਬਣ ਚੁੱਕੇ ਹਨ ਜੋ ਸਿੱਖਿਆ ਵਿੱਚ ਆਪਣਾ ਵਧੀਆ ਯੋਗਦਾਨ ਪਾਉਂਦੇ ਹਨ